ਤਕਨੀਕੀ ਹੁਨਰ ਬਾਰੇ ਜਾਣਕਾਰੀ ਦਿੰਦੇ ਆ ਸਾਡੀ ਮੇਰੀ ਉਮਰ ਤਾਂ ਸੱਤਰ ਸਾਲ ਦੇ ਕਰੀਬ ਪਹੁੰਚ ਚੁੱਕੀ ਹੈ ਔਰ ਦੇ ਜ਼ਮਾਨੇ ਦੇ ਵਿੱਚ ਤਾਂ ਬਹੁਤ ਫਰਕ ਸੀਗਾ ਅੱਗੇ ਅਸੀਂ ਖੇਡਾਂ ਵੀ ਖੇਡਦੇ ਗੁੱਲੀ ਡੰਡਾ ਖੇਡਣਾ ਖੁੱਦੋ ਖੂਨੀ ਖੇਡਣਾ ਇੱਦਾਂ ਦੇ ਰੀਤੀ ਰਿਵਾਜ ਸੀ ਜਾਂ ਅਸੀਂ ਵਾਲੀਬਾਲ ਖੇਡਣਾ ਕਬੱਡੀ ਖੇਡਣਾ ਇਹ ਪੁਰਾਣੀਆਂ ਸੀਗੀਆਂ ਜ਼ਰੂਰ ਅੱਜ ਕੱਲ੍ਹ ਦਾ ਮ ਜਿਹਾ ਮਾਹੌਲ ਮਤਲਬ ਬਹੁਤ ਚੇਂਜ ਹੋ ਗਿਆ ਇੰਟਰਨੈਟ ਦੇ ਲਾ ਲਓ ਜਾਂ ਕੋਈ ਜ਼ਮਾਨਾ ਇੱਦਾਂ ਦਾ ਰਫਤਾਰ ਚੱਲ ਰਿਹਾ ਜੋ ਜਿਹੜੇ ਬੈਠੇ ਉਹ ਆਪਾਂ ਟੀ ਵੀ 'ਤੇ ਵੀ ਇੱਦਾਂ ਦੇ ਪ੍ਰੋਗਰ ਚਲਦੇ ਹੈਗੇ ਆ ਜਿਹੜੇ ਆਪਾਂ ਦੇਖ ਸਕਦੇ ਹਾਂ ਔਰ ਸਾਡੇ ਵੇਲੇ ਤਾਂ ਇੱਦਾਂ ਦਾ ਕੁਛ ਨਹੀਂ ਸੀਗਾ ਸਾਡੇ ਵੇਲੇ ਤਾਂ ਠੀਕ ਆ ਵੀ ਮਤਲਬ ਠੀਕ ਆ ਵੀ ਵੀ ਠੀਕ ਅਸੀਂ ਖੇਡ ਪੇਡ ਕੇ ਆਪਦਾ ਸਕੂਲ ਵੀ ਇੱਦਾਂ ਜਾਂਦੇ ਸੀਗੇ ਅਤੇ ਜਿਸ ਕਰਕੇ ਸਾਡਾ ਮਤਲਬ ਟਾਈਮ ਵਧੀਆ ਉਦੋਂ ਸੀਗਾ ਹੁਣ ਦੇ ਜ਼ਮਾਨੇ ਵਿੱਚ ਫਰਕ ਬਹੁਤ ਸੀਗਾ ਪਹਿਲਾਂ ਜ਼ਮਾਨਾ ਬਹੁਤ ਵਧੀਆ ਸਾਨੂੰ ਤਾਂ ਇਹ ਵਧੀਆ ਲੱਗਦਾ ਸੀਗਾ ਹੁਣ ਦੇ ਜ਼ਮਾਨੇ ਵਿੱਚ ਤਾਂ ਬਹੁਤ ਰਫਤਾਰ ਆ ਪੈਸਾ ਬਹੁਤ ਚਾਹੀਦਾ ਹੋਰ ਬਹੁਤ ਚਾਹੀਦਾ ਉਦੋਂ ਕੋਈ ਨਾ ਗੱਲ ਨਹੀਂ ਸੀ